ਅੱਠ ਅਗਸਤ ਦੋ ਹਜ਼ਾਰ ਨੌ ਦੋ ਅਗਸਤ ਦੋ ਹਜ਼ਾਰ ਚਾਰ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਚੌਵੀ ਅਗਸਤ ਦੋ ਹਜ਼ਾਰ ਪੰਜ ਪੰਦਰਾਂ ਅਪ੍ਰੈਲ ਦੋ ਹਜ਼ਾਰ ਛੇ